ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆ ਹੈ ਜੇਕਰ ਮੈਂ ਗੱਲ ਕਰਾਂ ਜ਼ਿੰਦਗੀ ਦੀ ਬਹੁਤ ਵੱਡੀ ਚੁਣੌਤੀ ਦੀ ਤਾਂ ਇੱਕ ਸਮਾਂ ਐਸਾ ਸੀ ਜਦੋਂ ਮੇਰੇ ਪਲੱਸ ਟੂ ਬੋਰਡ ਦੇ ਇਗਜ਼ਾਮ ਹੋਣੇ ਸਨ ਅਤੇ ਉਹਨਾਂ ਬੋਰਡ ਦੇ ਇਗਜ਼ਾਮ ਦਾ ਜਿਹੜਾ ਪਹਿਲਾ ਪੇਪਰ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਮੇਰੀ ਤਬੀਅਤ ਜਿਹੜੀ ਸੀ ਉਹ ਖ਼ਰਾਬ ਹੋ ਗਈ ਸੀ ਅਤੇ ਮੈਨੂੰ ਹੋਸਟ ਹੋਸਪੀਟਲ ਵਿੱਚ ਦਾਖ਼ਲ ਕਰ ਦਿੱਤਾ ਗਿਆ ਸੀ ਅਤੇ ਕਿੰਨੇ ਦਿਨ ਹੋ ਗਏ ਸੀ ਅਤੇ ਹਫ਼ਤੇ ਤੋਂ ਵੱਧ ਮੈਂ ਮੇਰੀ ਤਬੀਅਤ ਵਿੱਚ ਕੋਈ ਵੀ ਸੁਧਾਰ ਨਹੀਂ ਸੀ ਆ ਰਿਹਾ ਉੱਤੋਂ ਮੇਰੀ ਬੋਰਡ ਦੀ ਪ੍ਰੀਖਿਆ ਸੀ ਜਿਹਨਾਂ ਵਿੱਚ ਪਾਸ ਹੋਣਾ ਮੇਰੇ ਲਈ ਬਹੁਤ ਹੀ ਜ਼ਰੂਰੀ ਸੀ ਜਿੱਥੇ ਮੇਰੇ ਪੂਰਾ ਕਰੀਅਰ ਜਿਹੜਾ ਸੀ ਉਹ ਡਿਪੈਂਡ ਕਰਦਾ ਸੀ ਅਤੇ ਮੈਂ ਬਹੁਤ ਹੀ ਮੁਸ਼ਕਲ ਸਮੇਂ ਦਾ ਦੋ ਵਿੱਚ ਮੁਸ਼ਲ ਮੁਸ਼ਕਲ ਸਮੇਂ ਵਿੱਚ ਪੈ ਗਈ ਸੀ ਅਤੇ ਮੈਂ ਜਿਵੇਂ ਤਿਵੇਂ ਕਰ ਕੇ ਜਿੱਦਾਂ ਮੈਨੂੰ ਟਾਈਮ ਲੱਗਦਾ ਸੀ ਜਿਵੇਂ ਮੇਰੀ ਸਿ ਸਿਹਤ ਵਿੱਚ ਥੋੜ੍ਹਾ ਜਿਹਾ ਸੁਧਾਰ ਹੁੰਦਾ ਸੀ ਬੈਠਣ ਵਿੱਚ ਬਹੁਤ ਦਿੱਕਤ ਹੁੰਦੀ ਸੀ ਮੇਰੇ ਕੋਲ ਬੈਠ ਕੇ ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਸੀ ਜਾਂਦਾ ਬਟ ਮੈਂ ਫਿਰ ਵੀ ਬਹੁਤ ਕੋਸ਼ਿਸ਼ ਕਰਦੀ ਸੀ ਤਾਂ ਜੋ ਮੈਂ ਆਪਣੇ ਪੇਪਰ ਵਿੱਚ ਉਤੇਰਨ ਹੋ ਸਕਾਂ ਅਤੇ ਮੈਂ ਬੜੀ ਹੀ ਮੁਸ਼ਕਲ ਨਾਲ ਅ ਦੋਵੇਂ ਪ੍ਰੀਖਿਆ ਦਿੱਤੀਆਂ ਸਨ ਅਤੇ ਮੈਨੂੰ ਪ੍ਰੀਖਿਆ ਦੀ ਜਦੋਂ ਪ੍ਰੀਖਿਆ ਹੋਲ ਵਿੱਚ ਬੈਠੀ ਤਾਂ ਉਹਦੇ ਵਿੱਚ ਬੈਠਣ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੋ ਹੋ ਰਹੀ ਸੀ ਪਰ ਜਿਵੇਂ ਤਿਵੇਂ ਮੈਂ ਆਪਣੇ ਪੇਪਰ ਦਿੱਤੇ ਅਤੇ ਮੈਂ ਪਾਸ ਹੋ ਗਈ ਧੰਨਵਾਦ